ਮੇਰਾ ਦਾਗ਼ਿਸਤਾਨ ਕਿਤਾਬ ਜੋ ਕਿ ਮੇਰੀ ਮਾਸੀ ਦੇ ਮੁੰਡੇ ਨੇ ਗੁਰਵਿੰਦਰਜੀਤ ਸਿੰਘ ਨੇ ਮੈਨੂੰ ਇਹ ਰਿਕਮੈਂਡ ਕਰੀ ਸੀ ਮੈਂ ਉਹਦੇ ਕੋਲ ਤੋਂ ਇਹ ਕਿਤਾਬ ਲੈ ਕੇ ਆਇਆ ਸੀ ਉਹ ਪੰਜਾਬ ਯੂਨੀਵਰਸਿਟੀ ਲਾਇਬ੍ਰੇਰੀ ਤੋਂ ਲੈ ਕੇ ਆਇਆ ਕਿਉਂਕਿ ਉਹਦਾ ਕਾਰਡ ਬਣਿਆ ਹੋਇਆ ਮੈਂ ਨੋਨ ਸਟੂਡੈਂਟ ਹਾਂ ਮੈਂ ਇਸ ਵਾਰ ਉਹ ਤੋਂ ਕਿਤਾਬ ਇਹ ਕੁਲੈਕਟ ਕਰੀ ਅਤੇ ਮੈਂ ਉਹਨੂੰ ਪੜ੍ਹ ਰਿਹਾਂ ਅਤੇ ਮੈਨੂੰ ਬਹੁਤ ਵਧੀਆ ਲੱਗੀ ਇਹਦੇ ਵਿੱਚ ਮੇਰੇ ਸਿੱਖਾਂ ਬਾਰੇ ਵੀ ਸਿੱਖਾਂ ਨੂੰ ਕਿਵੇਂ ਦਿਸ ਮੋਸਟ ਮੋਡੀਫਾਈ ਕਰਿਆ ਗਿਆ ਮਹਾਰਾਜਾ ਰਣਜੀਤ ਸਿੰਘ ਮਹਾਂ ਦਲੀਪ ਮਹਾ ਮਹਾਰਾਜਾ ਦਲੀਪ ਸਿੰਘ ਨੂੰ ਕਿਵੇਂ ਅੰਗਰੇਜ਼ਾਂ ਨੇ ਪੰਜਾਬ 'ਚੋਂ ਉਹਨੂੰ ਮਤਲਬ ਇੱਕ ਮੂਰਖ਼ਤਾ ਦੇ ਆਧਾਰ 'ਤੇ ਉਹਨੂੰ ਬਾਹਰ ਇੰਗਲੈਂਡ ਲੈ ਕੇ ਗਏ ਉਹ ਤੋਂ ਬਾਅਦ ਮੇਰਾ ਦਾਗ਼ਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਸਿੱਖਾਂ ਵਾਸਤੇ ਪੋਜ਼ੀਟੀਵਿਟੀ ਹੈ ਅਤੇ ਸਿੱਖਾਂ ਦੇ ਇਤਿਹਾਸ ਬਾਰੇ ਬਹੁਤ ਜ਼ਿਆਦਾ ਦੱਸਿਆ ਗਿਆ ਹੈ ਅਤੇ ਅਜੇ ਫ਼ਿਲਹਾਲ ਮੇਰੀ ਇਹ ਅੱਧੀ ਹੀ ਅੱਧ ਵਿੱਚ ਹੀ ਮੈਂ ਪੜ੍ਹ ਰਿਹਾਂ ਮੇਰਾ ਦਾਗ਼ਿਸਤਾਨ ਇਹ ਮੈਨੂੰ ਮੇਰੇ ਬ੍ਰਦਰ ਨੇ ਰਿਕਮੈਂਡ ਕਰੀ ਸੀ ਮੈਂ ਇਹਦੇ ਬਾਰੇ ਇੰਨਾ ਕੁਝ ਹੀ ਦੱਸ ਸਕਦਾ ਜੀ